ਪੰਜਾਬ ਵਿੱਚ ਸਰਕਾਰੀ ਸਕੀਮਾਂ ਜਿਵੇਂ ਨਰੇਗਾ ਹੋ ਗਈ ਆਟਾ ਦਾਲ ਸਕੀਮ ਹੋ ਗਈ ਫਰੀ ਐਜੂਕੇਸ਼ਨ ਹੋ ਗਿਆ ਅਤੇ ਹੈਲਥ ਨਾਲ ਸੰਬੰਧੀ ਆਯੂਸ਼ਮਾਨ ਕਾਰਡ ਬਣਦੇ ਨੇ ਜਿਵੇਂ ਨਰੇਗਾ ਸੀਅ ਸਕੀਮ ਹੈ ਉਹਦੇ ਵਿੱਚ ਕੀ ਹੈ ਆਪਾਂ ਨੂੰ ਦੇਖੋ ਸਾਲ ਵਿੱਚ ਸੌ ਦਿਨ ਦਾ ਰੁਜ਼ਗਾਰ ਦਿੱਤਾ ਜਾਂਦਾ ਜਿਹਦੇ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਠੀਕ ਹੈ ਜਿਵੇਂ ਹੁਣ ਆਪਣੀ ਆਟਾ ਦਾਲ ਸਕੀਮ ਹੋ ਗਈ ਇਹਦੇ ਜਿਹੜੇ ਗਰੀਬੀ ਰੁੱਖ ਗ੍ਰੇ ਰੇਖਾ ਤੋਂ ਨੀਚੇ ਲੋਕ ਨੇ ਉਹਨਾਂ ਨੂੰ ਦਾਲ ਚਾਵਲ ਆਟਾ ਦਿੱਤਾ ਜਾਂਦਾ ਤਾਂ ਕਿ ਉਹਨਾਂ ਦਾ ਰਾਸ਼ਨ ਨਾਲ ਸੰਬੰਧੀ ਕੋਈ ਵੀ ਪ੍ਰੋਬਲਮ ਹੈ ਉਹ ਸੋਲਵ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਫਰੀ ਐਜੂਕੇਸ਼ਨ ਹੈ ਇਹਦੇ ਨਾਲ ਹੈ ਜਿਨ੍ਹਾਂ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਹੈ ਨਾ ਉਹ ਆਪਣੀ ਐਜੂਕੇਸ਼ਨ ਇਹਦੇ ਨਾਲ ਲੈ ਸਕਦੇ ਨੇ ਠੀਕ ਹੈ ਉਸ ਤੋਂ ਬਾਅਦ ਹੈ ਜਿਹੜੀ ਹੈਗੀ ਆਯੂਸ਼ਮਾਨ ਕਾਰਡ ਹੈ ਦੇਖੋ ਜੇ ਸਾਨੂੰ ਕੋਈ ਵੱਡੀ ਬਿਮਾਰੀ ਆ ਜਾਂਦੀ ਹੈ ਅਸੀਂ ਉਹ ਕਾਰਡ ਦੇ ਥਰੂ ਜਾ ਕੇ ਵੱਡੇ ਵੱਡੇ ਹੌਸਪੀਟਲਸ ਜਾ ਕੇ ਆਪਣੀ ਜਿਹੜੀ ਗੰਭੀਰ ਬਿਮਾਰੀ ਹੈ ਉਹਦਾ ਇਲਾਜ ਕਰਵਾ ਸਕਦੇ ਹਾਂ ਤਾਂ ਸਾਨੂੰ ਇਵੇਂ ਹੁੰਦਾ ਕਿ ਜੇ ਸ ਅਸੀਂ ਕੋਈ ਆਪਣੀ ਬਿਮਾਰੀ ਦਾ ਇਲਾਜ ਕਰਵਾਉਣਾ ਉਹਦੇ ਲਈ ਸਾਨੂੰ ਮੇਨ ਸਭ ਤੋਂ ਪ੍ਰੋਬਲਮ ਕੀ ਆਉਂਦੀ ਕਿ ਸਾਡੇ ਕੋਲ ਪੈਸੇ ਹੋਣ ਜੇ ਸਾਡੇ ਕੋਲ ਕਾਰਡ ਹੋਊਗਾ ਉਸ ਨਾਲ ਸਾਨੂੰ ਪੰਜ ਲੱਖ ਦੀ ਦੀ ਰਾਸ਼ੀ ਦਾ ਸਾਨੂੰ ਸੇਵਾਵਾਂ ਮਿਲਦੀਆਂ ਹਨ ਤਾਂ ਅਸੀਂ ਉਹ ਪੰਜ ਲੱਖ ਦੇ ਨਾਲ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਆਂ ਥੈਂਕ ਯੂ